ਅਸੀਂ ਸਭ ਤੋਂ ਪਹਿਲਾਂ ਆਪਣੇ ਸਕੂਲ ਵਿੱਚ ਪੇਂਟਿੰਗ ਸਿੱਖੀ ਜੋ ਕਿ ਇੱਕ ਪੇੜ ਔਰ ਪਹਾੜ ਹੀ ਸਿਖਾਉਂਦੇ ਸੀ ਉਸ ਤੋਂ ਸਾਨੂੰ ਇਹ ਪਤਾ ਲੱਗਿਆ ਵੀ ਕਿਸ ਤਰ੍ਹਾਂ ਕਿਹੜੀ ਚੀਜ਼ ਦੀ ਸ਼ੇਪ ਬਣਦੀ ਹੈ ਇਹੀ ਸਾਡੀ ਪਹਿਲੀ ਪੇਂਟਿੰਗ ਸੀ